ਪੰਜਾਬੀ ਦੀ ਕਵਿਤਾ ਨਗਰੀ ਵਿੱਚ ਮੇਰਾ ਮਨਪਸੰਦ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਹੈ ਉਸਦਾ ਜਨਮ ਉੱਨੀ ਸੌ ਛੱਤੀ ਵਿੱਚ ਹੋਇਆ ਸੀ ਅਤੇ ਉਹ ਬਿਰਹੋ ਦਾ ਕਵੀ ਕਹਿਲਾਇਆ ਜਾਂਦਾ ਹੈ ਉਸਦੀਆਂ ਉਹ ਦਰਦ ਭਰੀਆਂ ਕਵਿਤਾਵਾਂ ਪ੍ਰੇਮ ਭਰੀਆਂ ਪ੍ਰੇਮੀ ਦੇ ਦਰਦ ਨੂੰ ਦੱਸਣ ਵਾਲੀਆਂ ਕਵਿਤਾਵਾਂ ਲਿਖਣ ਵਿੱਚ ਪ੍ਰਸਿੱਧ ਹੈ ਅਤੇ ਉਸਦੀ ਹਰ ਇੱਕ ਕਵਿਤਾ ਵਿੱਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਹੁੰਦਾ ਹੈ ਉਸਦੀ ਜੋ ਸਭ ਤੋਂ ਪ੍ਰਸਿੱਧ ਕਵਿਤਾ ਜੋ ਮੈਨੂੰ ਲੱਗਦੀ ਹੈ ਉਹ ਹੈ ਅਸਾਂ ਜੋਬਨ ਰੁੱਤੇ ਤੁਰ ਜਾਣਾ ਉਸ ਵਿੱਚ ਉਹ ਦੱਸਦਾ ਹੈ ਕਿ ਜੋਬਨ ਰੁੱਤ ਵਿੱਚ ਜਾਂ ਤਾਂ ਪ੍ਰੇਮੀ ਮਰਦੇ ਹਨ ਅਤੇ ਜਾਂ ਤਾਂ ਕੋਈ ਕਰਮਾਂ ਵਾਲੇ ਕਿਉਂਕਿ ਉਹ ਫੁੱਲ ਬਣਦੇ ਹਨ ਜਾਂ ਤਾਰਾ ਬਣਦੇ ਹਨ ਉਸਦੀ ਹਰ ਇੱਕ ਕਵਿਤਾ ਵਿੱਚ ਇੱਕ ਦਰਦ ਮਹਿਸੂਸ ਹੁੰਦਾ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਫੀਲ ਕਰ ਸਕਦੇ ਹੋ ਇਸ ਕਰਕੇ ਸ਼ਿਵ ਕੁਮਾਰ ਬਟਾਲਵੀ ਮੇਰਾ ਪਸੰਦੀਦਾ ਕਵੀ ਹੈ